ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਪੰਜਾਬ 'ਚ ਨਾ ਨਵੇਂ ਨਵੇਂ ਆਏ ਹਾਂ ਅਤੇ ਸਾਨੂੰ ਨਾ ਜੁੱਤੀਆਂ ਅਤੇ ਫੁਲਕਾਰੀਆਂ ਅਸੀਂ ਖਰੀਦਣਾ ਚਾਹੁੰਦੇ ਸੀ ਤੁਸੀਂ ਦੱਸੋਗੇ ਸਾਨੂੰ ਕਿ ਪੰਜਾਬ 'ਚ ਕਿੱਥੇ ਵਧੀਆ ਜੁੱਤੀਆਂ ਅਤੇ ਫੁਲਕਾਰੀਆਂ ਮਿਲਣਗੀਆਂ ਸਾਨੂੰ ਠੀਕ ਹੈ ਮੈਡਮ ਅਤੇ ਮੈਨੂੰ ਦੱਸ ਦਿਓ ਪਟਿਆਲੇ ਦੇ ਵਿੱਚ ਕਿਸ ਮਾਰਕੀਟ 'ਚ ਬਜ਼ਾਰ 'ਚ ਜੁੱਤੀਆਂ ਵਧੀਆ ਮਿਲ ਜਾਣਗੀਆਂ ਅਤੇ ਇਸ ਤੋਂ ਇਲਾਵਾ ਹੋਰ ਕੋਈ ਜ਼ਿਲ੍ਹਾ ਮੈਮ ਸਾ ਹਰ ਜ਼ਿਲ੍ਹੇ ਤੋਂ ਮੈਂ ਲੈ ਸਕਦੀ ਹਾਂ ਮਤਲਬ ਹੋਲਸੇਲ ਰੇਟ 'ਤੇ ਅਗਰ ਮੈਂ ਅੱਗੇ ਜਾ ਵੇਚਣੀਆਂ ਹੋਣ ਤਾਂ ਮੈਂ ਕਿਤੋਂ ਵੀ ਲੈ ਸਕਦੀ ਹਾਂ ਫਿਰ ਜੁੱਤੀਆਂ

ਅਤੇ ਫੁਲਕਾਰੀਆਂ ਲਈ ਮੈਡਮ ਦੱਸੋਗੇ ਫੁਲਕਾਰੀਆਂ ਲਈ ਵੀ ਇੱਕ ਠੀਕ ਹੈ ਮੈਡਮ ਚਲੋ ਮੈਂ ਸਾਰ ਜਾ ਤਿੰਨ ਜ਼ਿਲ੍ਹਿਆਂ 'ਚ ਵਿਜ਼ਿਟ ਕਰਕੇ ਦੇਖਦੀ ਹਾਂ ਜਿੱਥੋਂ ਮੈਨੂੰ ਸਹੀ ਲੱਗਿਆ ਮੈਂ ਦੇਖ ਲਵਾਂਗੀ ਮੈਡਮ ਧੰਨਵਾਦ ਤੁਹਾਡਾ ਮੈਨੂੰ ਜਾਣਕਾਰੀ ਦੇਣ ਲਈ